ਮੈਂ ਇਹ ਸੋਚਦੀ ਹਾਂ ਕਿ ਸਿੱਖਿਆ ਦੀ ਕੋਈ ਘਾਟ ਨਹੀਂ ਹੈ ਅਤੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਦੇ ਲੋਕ ਵੀ ਉਹਨਾਂ ਦੇ ਬਰਾਬਰ ਖੜ੍ਹੇ ਮਿਲਦੇ ਹਨ ਜਿਸ ਵੀ ਖੇਤਰ ਵਿੱਚ ਆਪਾਂ ਦੇਖ ਲਈਏ ਜਿਵੇਂ ਕਿ ਹੁਣ ਹਰ ਵਿਅਕਤੀ ਜੋ ਕਿ ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਦੀ ਪ੍ਰੀਖਿਆ ਵਿੱਚੋਂ ਅੱਵਲ ਆਏ ਹਨ ਜ਼ਿਆਦਾਤਰ ਉਹ ਪੇਂਡੂ ਖੇਤਰਾਂ ਦੇ ਰਹਿਣ ਵਾਲੇ ਹਨ ਪਰ ਹਰੇਕ ਪਿੰਡ ਦੇ ਵਿੱਚ ਸਕੂਲ ਨਾ ਹੋਣ ਕਰਕੇ ਜਿਆਦਾ ਪੈਂਡਾ ਤੈਅ ਕਰਕੇ ਬੱਚਿਆਂ ਨੂੰ ਹੋਰ ਪਿੰਡਾਂ ਵਿੱਚ ਸਕੂਲ ਪੜ੍ਹਨਾ ਜਾਣਾ ਪੈਂਦਾ ਹੈ ਜਿਸ ਕਾਰਨ ਕੁਝ ਮਾਂ ਬਾਪ ਉਹਨਾਂ ਨੂੰ ਸਕੂਲ ਨਹੀਂ ਭੇਜਦੇ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਇਹ ਸਭ ਤੋਂ ਬੜਾ ਮੁੱਦਾ ਹੈ ਕਿ ਸ ਹਰੇਕ ਪਿੰਡ ਦੇ ਵਿੱਚ ਸਕੂਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਗਰੀਬ ਤੋਂ ਗਰੀਬ ਵਿਅਕਤੀ ਵੀ ਆਪਣੇ ਬੱਚੇ ਨੂੰ ਪੜ੍ਹਾ ਸਕੇ